ਹੈਲੋ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਹਾਂਜੀ ਭਾਅ ਜੀ ਤੁਸੀਂ ਅਭਿਸ਼ੇਕ ਬੋਲਦੇ ਮੈਂ ਭਾਅ ਜੀ ਸ਼ਾਰਨ ਮੈਨੂੰ ਐਕਚੁਲੀ ਨਾ ਇੱਕ ਦੋਸਤ ਨੰਬਰ ਦਿੱਤਾ ਸੀਗਾ ਰੋਬਿਨ ਨੇ ਤੁਹਾਡਾ ਤੋਂ ਪੁੱਛਣਾ ਸੀ ਕਿ ਸ਼ਹਿਰ 'ਚ ਬੇਕਰੀ ਸ਼ੋਪ ਕਿੱਥੇ ਵਧੀਆ ਮੈਂ ਭਾਅ ਜੀ ਪੈਟੀ ਵਗੈਰਾ ਉਹ ਕਿੱਥੇ ਆ ਅੱਛਾ ਜੀ ਅੱਛਾ ਜੀ

ਅਸੀਂ ਸ਼ਾਮ ਨੂੰ ਨਹੀਂ ਮਿਲਣੀ ਇਹ ਖਾਣੀ ਸ਼ਾਮ ਹਨਾ ਅੱਛਾ ਤੇ ਹੋਰ ਕਿਹੜੀਆਂ ਕਿਹੜੀਆਂ ਪੇਟੀਆਂ ਮਿਲਦੀਆਂ ਇਹਨਾ ਕੋਲ ਮਤਲਬ ਅੱਛਾ ਜੀ ਅੱਛਾ ਜੀ ਇਹ ਹੋਰ ਭਾਅ ਜੀ ਮੈਂ ਇੱਥੇ ਇੱਕ ਰਾਜੇਸ਼ ਵੇਕਰੀ ਬਾਰੇ ਬਹੁਤ ਸੁਣਿਆ ਅੱਛਾ ਜੀ ਤੇ ਉਹ ਕਿੱਥੇ ਹਾਂਜੀ ਉਹ ਵੀ ਕਿੱਥੇ ਤੇ ਭਾਅ ਜੀ ਇੱਕ ਮੈਂ ਲਵਲੀ ਮੈਂ ਕਈ ਵਾਰ ਵੀ ਸੁਣਿਆ ਵਾ ਹਾਂਜੀ ਅੱਛਾ ਜੀ ਹਾਂਜੀ ਅੱਛਾ ਜੀ ਤੇ ਮਤਲਬ ਹਾਂਜੀ ਤੇ ਮਤਲਬ ਤੁਸੀਂ ਪ੍ਰੈਫਰ ਕਿਹੜਾ ਕਰੋਗੇ ਖਾਣੀ ਹੋਵੇ ਜੇ ਮਤਲਬ ਕੁਝ ਵੀ ਖਾਣਾ ਹੋਵੇ ਬੇਕਰੀ ਦੀ ਆਈਟਮ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਤੇ ਭਾਅ ਜੀ ਮੈਂ ਭਾਅ ਜੀ ਮਤਲਵ ਪੈਟੀ ਵਗੈਰਾ ਹੀ ਖਾਣੀਆ ਜਿਆਦਾ ਪੈਟੀ ਆ ਕੁਲਚਾ ਹੋ ਗਿਆ ਆਲੂ ਕਲਤਾ ਚ ਕੀ ਹੁੰਦਾ ਭਾਅ ਜੀ ਬਸ ਇਹੀ ਲੋ ਜੀ ਮਸਾਲੇ ਮਦੇ ਉਹ ਵੀ ਵਧੀਆ ਹੁੰਦੀ ਅੱਛਾ ਜੀ ਹਾਂਜੀ ਚਲੋ ਫਿਰ ਮੈਂ ਤੁਹਾਨੂੰ ਦੱਸਤਾ ਭਾਅ ਜੀ ਸਰਤਾਜ ਬੇਰੀ ਦੇ ਆਹ ਸਰਤਾਰ ਬੇਕਰੀ ਕਿੱਤੇ ਪੈ ਜਾਂਦੀ ਅੱਛਾ ਜੀ ਅੱਛਾ ਜੀ ਠੀਕ ਭਾਅ ਜੀ ਥੈਂਕਯੂ ਭਾਅ ਜੀ ਦੱਸਣ ਲਈ ਓਕੇ ਜੀ ਓਕੇ ਭਾਅ ਜੀ ਓਕੇ